ਮੇਰਾ ਨਾਮ ਨੈਨਸੀ ਹੈ ਮੈਂ ਆਪਣੀ ਫੈਮਲੀ ਨਾਲ ਮਿਲ ਕੇ ਆਪਣੇ ਮੁਹੱਲੇ ਦੀ ਸਫਾਈ ਕਰਵਾਈ ਹੈ ਮੈਨੂੰ ਦੇਖ ਕੇ ਔਰ ਮੇਰੀ ਫੈਮਲੀ ਨੂੰ ਦੇਖ ਕੇ ਮੁਹੱਲੇ ਦੇ ਲੋਕ ਵੀ ਸਾਡੇ ਸਾਰੇ ਪਿੰਡ ਦੀ ਸਫਾਈ ਕਰਨ ਲੱਗ ਪਏ ਅਤੇ ਸਾਡਾ ਸਾਰਾ ਮੁਹੱਲਾ ਬਹੁਤ ਹੀ ਵਧੀਆ ਅਤੇ ਸਾਫ ਸੁਥਰਾ ਬਣ ਗਿਆ ਸਾਡੇ ਮੁਹੱਲੇ ਦੇ ਲੋਕ ਅਤੇ ਬੱਚੇ ਵੀ ਬਿਮਾਰੀਆਂ ਤੋਂ ਬਚ ਗਏ ਹਨ ਨਹੀਂ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਵਗੈਰਾ ਲੱਗ ਜਾਣੀਆਂ ਸੀ ਸਾਨੂੰ ਆਪਣਾ ਪਿੰਡ ਬਹੁਤ ਹੀ ਵਧੀਆ ਰੱਖਣਾ ਚਾਹੀਦਾ ਹੈ ਸਾਨੂੰ ਦੇਖ ਕੇ ਨਾਲ ਦੇ ਪਿੰਡ ਵਾਲੇ ਵੀ ਸਫਾਈ ਆਪਣੇ ਪਿੰਡ ਦੀ ਸਫਾਈ ਕਰਨ ਲੱਗ ਪਏ ਅਤੇ ਉਹਨਾਂ ਦੇ ਪਿੰਡ ਵਿੱਚ ਵੀ ਸੁਧਾਰ ਹੋ ਗਿਆ ਅਤੇ ਸਾਡਾ ਪੂਰਾ ਦੇਸ਼ ਸਾਫ ਸੁਥਰਾ ਬਣ ਗਿਆ ਮੈਨੂੰ ਇਸ ਗੱਲ 'ਤੇ ਬਹੁਤ ਖੁਸ਼ੀ ਹੋਈ ਕਿ ਸਾਡਾ ਦੇਸ਼ ਸਾਫ ਸੁਥਰਾ ਬਣ ਗਿਆ ਅਤੇ ਮੈਨੂੰ ਆਪਣੇ ਔਰ ਨਾਲ ਦੇ ਲੋਕਾਂ 'ਤੇ ਬਹੁਤ ਮਾਣ ਹੋਇਆ